ਹੈਲੋ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਹੋਰ ਠੀਕ ਹੋ ਜੀ ਠੀਕ ਹੈ ਜੀ ਅੱਜ ਕਿੱਦਾਂ ਯਾਦ ਕੀਤਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਕਿੰਨੇ ਕੁ ਦਿਨ ਦਾ ਪ੍ਰੋਗਰਾਮ ਬਣਾਉਣਾ ਜੀ ਠੀਕ ਹੈ ਜੀ ਆਪਣੇ ਨੇੜੇ ਜਿਹੜੇ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਭਾਊ ਸਾਹਿਬ ਹੈ ਜੀ ਫੇਸ ਅੱਠ ਦੇ ਵਿੱਚ ਅਤੇ ਆਪਣਾ ਅੰਗੀਠਾ ਸਾਹਿਬ ਗੁਰਦੁਆਰਾ ਹੈਗਾ ਉਹ ਵੀ ਫੇਸ ਅੱਠ ਦੇ ਵਿੱਚ ਹੈਗਾ ਉਸ ਤੋਂ ਬਾਅਦ ਰੋਪੜ ਡਿਸਟ੍ਰਿਕਟ ਵਿੱਚ ਨੇੜੇ ਮੋਹਾਲੀ ਜ਼ਿਲ੍ਹੇ ਦੇ ਨੇੜੇ ਹੀ ਹੈ ਸੋਲਖੀਆਂ ਗੁਰਦੁਆਰਾ ਸਾਹਿਬ ਹੈਗਾ ਬਾਬਾ ਦੀਪ ਸਿੰਘ ਜੀ ਦਾ ਅਤੇ ਉੱਥੇ ਆਪਾਂ ਜਾ ਸਕਦੇ ਹਾਂ ਬਾਕੀ ਸਿੱਖ ਧਰਮ ਨਾਲ ਰਿਲੇਟਡ ਵਿਰਾਸਤ ਏ ਖਾਲਸਾ ਆਨੰਦਪੁਰ ਸਾਹਿਬ ਦੇ ਨੇੜੇ ਹੈਗੇ ਜੀ ਉੱਥੇ ਜਾ ਸਕਦੇ ਹੈ ਅਤੇ ਅਨੰਦਪੁਰ ਸਾਹਿਬ ਜਾ ਸਕਦੇ ਤਖ਼ਤ ਸਾਹਿਬਾਨ 'ਤੇ ਠੀਕ ਹੈ ਜੀ ਅਤੇ ਦਾਊਂ ਸਾਹਿਬ ਹੈਗਾ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਹੀ ਪੈਂਦਾ ਆਪਣੇ ਅਤੇ ਹੁਣ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਹੈ ਸੋਹਾਣਾ ਜੀ ਕੋਈ ਨਹੀਂ ਮੇਰੀ ਗੱਡੀ ਹੈਗੀ ਹੈ ਮੈਂ ਟਾਈਮ ਕੱਢ ਲਵਾਗਾਂ ਆਪਣੇ ਦੋਸਤ ਕਰਕੇ ਟਾਈਮ ਕੱਢਣਾ ਹੈਗਾ ਅਤੇ ਆਓ ਤੁਸੀਂ ਪਰਿਵਾਰ ਸਮੇਤ ਆਓ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਘੁੰਮਾਵਾਂਗੇ ਜੀ ਅਤੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਮੈਨੂੰ ਡੇਟ ਹਾਂਜੀ ਡੇਟ ਫਿਕਸ ਹਾਂ ਮੈਨੂੰ ਡੇਟ ਫਿਕਸ ਕਰਕੇ ਦੱਸ ਦਿਓ ਜੀ ਅਤੇ ਮੈਂ ਫਿਰ ਅਵੇਲੇਬਲ ਰਹਾਂਗਾ ਜੀ ਉਸ ਟਾਈਮ ਓਕੇ ਜੀ ਓਕੇ ਓਕੇ